ਭੰਗੜਾ ਅਤੇ ਐਰੋਬਿਕਸ ਫਿਟਨਸ ਦੀ ਦੁਨੀਆਂ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਹੈ ਭੰਗੜਾ ਅਤੇ ਐਰੋਬਿਕਸ ਇੱਕ ਤਰ੍ਹਾਂ ਦਾ ਨਾਚ ਹੈ ਜਦੋਂ ਹੀ ਅਸੀਂ ਖੁਸ਼ ਹੁੰਦੇ ਹਾਂ ਤਾਂ ਉਸ ਖੁਸ਼ ਨੂੰ ਜ਼ਾਹਿਰ ਕਰਨ ਵਾਸਤੇ ਅਸੀਂ ਕੋਈ ਨਾ ਕੋਈ ਡਾਂਸ ਜਾ ਕਰਦੇ ਹਾਂ ਭੰਗੜਾ ਵੀ ਕੋਈ ਖੁਸ਼ੀ ਨੂੰ ਜ਼ਾਹਿਰ ਕਰਨ ਦਾ ਤਰੀਕਾ ਹੈ ਇਸ ਦੇ ਨਾਲ ਨਾਲ ਖੁਸ਼ੀ ਦਾ ਇਜ਼ਹਾਰ ਵੀ ਹੋ ਜਾਂਦਾ ਹੈ ਅਤੇ ਮਨ ਪਰਚਾਵਾ ਵੀ ਹੋ ਜਾਂਦਾ ਅਤੇ ਫਿਟਨੈਸ ਵੀ ਹੋ ਜਾਂਦੀ ਹੈ ਜਿਸ ਨਾਲ ਇਹ ਫਿਟਨੈਸ ਦੀ ਦੁਨੀਆਂ ਵਿੱਚ ਵਿਭਿੰਨਤਾ ਪੈਦਾ ਕਰਦਾ ਹੈ ਅਕਸਰ ਅਸੀਂ ਕਸਰਤ ਕਰ ਕਰਕੇ ਥੱਕ ਜਾਂਦੇ ਹਾਂ ਜਦ ਜਦੋਂ ਅਸੀਂ ਭੰਗੜਾ ਕਰਦੇ ਹਾਂ ਮਨ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਸ ਤੋਂ ਅਸੀਂ ਇਸ ਤੋਂ ਬੋਰ ਨਹੀਂ ਹੁੰਦੇ